ਬ੍ਰਹਿਮੰਡ ਗ੍ਰਹਿ ਅਤੇ ਉਪ ਗ੍ਰਹਿ ਕਾਫ਼ੀ ਸੰਖਿਆ ਵਿੱਚ ਪਾਏ ਜਾਂਦੇ ਹਨ ਗ੍ਰਹਿਆਂ ਵਿੱਚੋਂ ਇੱਕ ਧਰਤੀ ਅਜਿਹਾ ਗ੍ਰਹਿ ਹੈ ਜਿਸ 'ਤੇ ਮਨੁੱਖ ਜੀਵਨ ਸੰਭਵ ਹੈ ਅਤੇ ਇਸ ਤੋਂ ਇਲਾਵਾ ਬ੍ਰਹਿਮੰਡ ਦੇ ਵਿੱਚ ਹੋਰ ਕਾਫ਼ੀ ਇਹੋ ਜਿਹੇ ਗ੍ਰਹਿ ਹਨ ਜਿੰਨ੍ਹਾਂ 'ਤੇ ਵੀ ਜੀਵਨ ਅਤੇ ਜੀਵਨ ਸੰਭਵ ਹੈ ਅਤੇ ਆਕਸੀਜਨ ਪਾਣੀ ਵੀ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਯੂ ਐੱਫ ਓ ਨੇ ਨੋਟ ਕੀਤਾ ਹੈ ਕਿ ਮੰਗਲ ਅਤੇ ਕਾਫ਼ੀ ਹੋਰ ਗ੍ਰਹਿ ਹਨ ਜਿਨ੍ਹਾਂ 'ਤੇ ਮਨੁੱਖੀ ਜੀਵਨ ਸੰਭਵ ਹੈ ਅਤੇ ਸਾਡੀ ਸਿੱਖਾਂ ਦੀ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਕਿ ਬ੍ਰਹਿਮੰਡ ਤੋਂ ਇਲਾਵਾ ਸ੍ਰਿਸ਼ਟੀ ਵਿੱਚ ਬਹੁਤ ਜ਼ਿਆਦਾ ਇਹੋ ਜਿਹੀਆਂ ਚੀਜ਼ਾਂ ਵੀ ਹਨ ਜਿੱਥੇ ਜਿਨ੍ਹਾਂ ਤੋਂ ਅਸੀਂ ਅਜੇ ਤੱਕ ਵੀ ਜਾਣੂ ਨਹੀਂ ਹਾਂ ਅਤੇ ਕਾਫ਼ੀ ਜਿਵੇਂ ਇੱਕ ਗੁਰਬਾਣੀ ਦੇ ਵਿੱਚ ਤੁਕ ਲਿਖੀ ਵੀ ਆਉਂਦੀ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਇਸ ਤੋਂ ਭਾਵ ਹੈ ਕਿ ਬ੍ਰਹਿਮੰਡ ਦੇ ਅਨੁਸਾਰ ਆਪਾਂ ਇੱਕ ਬ੍ਰਹਿਮੰਡ ਨੂੰ ਦੇਖਿਆ ਹੈ ਜਿਸ 'ਤੇ ਆਪਾਂ ਇਸ ਧਰਤੀ 'ਤੇ ਰਹਿੰਦੇ ਹਾਂ ਧਰਤੀ 'ਤੇ ਰਹਿਣਾ ਸੰਭਵ ਹੀ ਤਾਂ ਹੈ ਪਰ ਇਸ ਤੋਂ ਇਲਾਵਾ ਹੋਰ ਵੀ ਕਾਫ਼ੀ ਜਗ੍ਹਾ 'ਤੇ ਜੀਵਨ ਸੰਭਵ ਹੁੰਦਾ ਹੈ ਅਤੇ